ਭੰਗੜਾ ਅਸਲ ਵਿੱਚ ਲੋਕ ਗੀਤ ਕਲੀਆਂ ਅਤੇ ਵਾਰਾਂ ਤੇ ਪਾਇਆ ਜਾਂਦਾ ਹੈ ਅੱਜ ਕੱਲ੍ਹ ਭੰਗੜਾ ਬੋਲੀਆਂ ਚ ਵੀ ਪਾਇਆ ਜਾਂਦਾ ਹੈ ਪੰਜਾਬੀ ਗਾਣੇ ਅਤੇ ਬੋਲੀਵੁੱਡ ਵਿੱਚ ਵੀ ਭੰਗੜਾ ਅਤੇ ਇਹਦੇ ਗਾਣੇ ਗਾਏ ਜਾਂਦੇ ਹਨ ਉਨਾਂ ਵਿੱਚੋਂ ਕਈ ਗਾਣੇ ਤੇ ਬਹੁਤ ਹੀ ਮਸ਼ਹੂਰ ਨੇ ਜਿਵੇਂ ਕੀ ਦੇ ਦੇ ਗੇੜਾ ਸ਼ੋਂਕ ਦਾ ਨਨਾਨੇ ਗੋਰੀਏ ਜੇ ਤੂੰ ਨੱਚੀ ਨਾ ਗੋਰੀਏ ਮੇਰੇ ਨਾਲ ਇਹ ਗਾਣਾ ਦਲਜੀਤ ਦੋਸਾਂਝ ਨੇ ਗਾਇਆ ਇਹਦੇ ਕਰਕੇ ਹੋਰ ਗਾਣੇ ਨੇ ਮੇਰੀ ਕਾਲੀ ਐਕਟਿਵਾ ਦਾ ਜੱਟ ਦਾ ਪਜਾਮਾ ਉੱਚਾ ਹੋ ਗਿਆ ਪਰ ਇਨ੍ਹਾਂ ਗਾਣੇ ਸੁਣਨ ਤੋਂ ਬਾਅਦ ਵੀ ਮੇਰਾ ਜਿਹੜਾ ਮਨਪਸੰਦ ਭੰਗੜਾ ਓਦੋਂ ਹੁੰਦਾ ਹੈ ਜਦੋਂ ਭੰਗੜਾ ਬੋਲੀਆਂ ਜਾਂ ਕਲੀਆਂ ਤੇ ਪਾਇਆ ਜਾਂਦਾ ਹੈ ਉਹਦੇ ਨਾਲ ਹੀ ਮੈਨੂੰ ਭੰਗੜਾ ਕਰਨਾ ਅੱਛਾ ਲੱਗਦਾ ਹੈ